ਪੰਜਾਬ ਵਿੱਚ ਪ੍ਰਮੁੱਖ ਤਿਉਹਾਰ ਜਿੱਦਾਂ ਦੀਵਾਲੀ ਈਦ ਕ੍ਰਿਸਮਸ ਵਿਸਾਖੀ ਗੁਰਪੁਰਬ ਹਰ ਤਰ੍ਹਾਂ ਦੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ ਜੇਕਰ ਅਸੀਂ ਦੀਵਾਲੀ ਦੀ ਗੱਲ ਕਰੀਏ ਤਾਂ ਦੀਵਾਲੀ ਦੇ ਉੱਤੇ ਲੋਕ ਪਟਾਕਿਆਂ ਨਾਲ ਲਕਸ਼ਮੀ ਮਾਤਾ ਦੀ ਪੂਜਾ ਨਾਲ ਇਸ ਤਿਉਹਾਰ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਹਨ ਕ੍ਰਿਸਮਸ 'ਤੇ ਲੋਕ ਬੱਚਿਆਂ ਨੂੰ ਸੈਂਟਾਂ ਬਣਾ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ ਵਿਸਾਖੀ ਤਿਉਹਾਰ ਬੜਾ ਧੂਮਧਾਮ ਨਾਲ ਮਨਾਇਆ ਜਾਂਦਾ ਦੁਸ਼ਹਿਰੇ 'ਤੇ ਅਸੀਂ ਰਾਵਣ ਦਹਿਨ ਕਰਕੇ ਉਸਨੂੰ ਵੀ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ ਜਿਸ ਕਰਕੇ ਬਜ਼ਾਰਾਂ ਵਿੱਚ ਵੀ ਬੜੀ ਰੌਣਕ ਲੱਗਦੀ ਹੈ ਪਰ ਪੰਜਾਬ ਵਿੱਚ ਤਾਂ ਹਰ ਤਰ੍ਹਾਂ ਦੇ ਤਿਉਹਾਰ ਨੂੰ ਬੜੀ ਰੀਝ ਨਾਲ ਮਨਾਇਆ ਜਾਂਦਾ ਹੈ ਲੋਕ ਹਰ ਤਿਉਹਾਰ ਨੂੰ ਬੜੀ ਖੁਸ਼ੀ ਨਾਲ ਆਪਣੇ ਆਪਣੇ ਘਰਾਂ 'ਚ ਆਪਣੀਆਂ ਸਹੇਲੀਆਂ ਨਾਲ ਆਪਣੇ ਦੋਸਤਾਂ ਨਾਲ ਹਰ ਕਿਸੇ ਨਾਲ ਇਹ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਲੋਕ ਖਰੀਦਦਾਰੀ ਵੀ ਬਹੁਤ ਕਰਦੇ ਹਨ ਕਿਤੇ ਕੁਛ ਸ ਘਰਾਂ ਦੀ ਸਜਾਵਟ ਨੂੰ ਲੈ ਕੇ ਗੱਲ ਕੀਤੀ ਜਾਏ ਤਾਂ ਘਰਾਂ ਵਿੱਚ ਦਿਨ ਤਿਉਹਾਰ 'ਤੇ ਸਜਾਵਟ ਵੀ ਬਹੁਤ ਕੀਤੀ ਜਾਂਦੀ ਹੈ ਸਫਾਈਆਂ ਕੀਤੀਆਂ ਜਾਂਦੀਆਂ ਹਨ ਲੋਕ ਹਰ ਤਿਉਹਾਰ ਨੂੰ ਬੜੇ ਪ੍ਰੇਮ ਭਾਵ ਨਾਲ ਮਨਾਉਂਦੇ ਹਨ ਵੀ ਜੇ ਵਿਸਾਖੀ ਦੀ ਗੱਲ ਕੀਤੀ ਜਾਏ ਤਾਂ ਕਿਸਾਨਾਂ ਲਈ ਵੀ ਇਹ ਤਿਉਹਾਰ ਬੜਾ ਵਧੀਆ ਮਨਾਇਆ ਗਿਆ ਹੈ ਲੋਕ ਕਿਸਾ ਕਿਸਾਨ ਵਾਢੀ ਕਰਦੇ ਹਨ ਜਿਸ ਵਿੱਚ ਕਿ ਉਹਨਾਂ ਨੂੰ ਵੀ ਬੜਾ ਵਧੀਆ ਮਹਿਸੂਸ ਹੁੰਦਾ ਹੈ ਈਦ ਦੇ ਤਿਉਹਾਰ 'ਤੇ ਵੀ ਲੋਕ ਈਦ ਨੂੰ ਬੜਾ ਵਧੀਆ ਮਨਾਉਂਦੇ ਹਨ ਲੋਕ ਮੱਥਾ ਟੇਕਣ ਜਾਂਦੇ ਹਨ ਗੁਰਪੁਰਬ ਦੀ ਗੱਲ ਕੀਤੀ ਜਾਏ ਅਤੇ ਲੋਕ ਗੁਰਪੁਰਬ ਲਈ ਵੀ ਲੰਗਰ ਪ੍ਰਸ਼ਾਦ ਲਾਉਂਦੇ ਹਨ ਹਰ ਤਰ੍ਹਾਂ ਦੇ ਗੁਰਦੁਆਰਿਆਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਬਹੁਤ ਰੌਣਕ ਲੱਗਦੀ ਹੈ ਹਰ ਤਿਉਹਾਰ ਨੂੰ ਇੱਥੇ ਸਾਡੇ ਪੰਜਾਬ ਵਿੱਚ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਲੋਕ ਇਸ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਅਤੇ ਬੜੀ ਸ਼ਰਧਾ ਨਾਲ ਮਨਾਉਂਦੇ ਹਨ